ਹੈਲੋ ਹਾਂਜੀ ਕਿਵੇਂ ਹੋ ਸ਼ਰਮਾ ਜੀ ਹਾਂਜੀ ਹਾਂ ਵਧੀਆ ਕਿਰਪਾ ਰੱਬ ਦੀ ਹੋਰ ਸੁਣਾਓ ਕੀ ਹਾਲ ਚਾਲ ਨੇ ਕਿਵੇਂ ਆ ਘਰ ਠੀਕ ਹੈ ਹਾਂ ਹਾਂ ਹੋਰ ਕਿਵੇਂ ਕੱਲ੍ਹ ਮੈਂ ਕੱਲ੍ਹ ਮੈਂ ਕਿਹਾ ਤੁਸੀਂ ਬੜੀ ਤੇਜ਼ ਜਾ ਰਹੇ ਸੀਗੇ ਸਕੂਟਰੀ 'ਤੇ ਅੱਛਾ ਜੀ ਟ੍ਰੈਫਿਕ ਹਾਂ ਹਾਂ ਹਾਂ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਅੱਜ ਕੱਲ੍ਹ ਜਿੱਧਰ ਵੀ ਦੇਖ ਲਓ ਹਾਂ ਆਪਣਾ ਹੋ ਉਹ ਜਾਂਦਾ ਹੋਰ ਬਹੁਤ ਜ਼ਿਆਦਾ ਟ੍ਰੈਫਿਕ ਹੋ ਚੁੱਕੀ ਅੱਜ ਕੱਲ੍ਹ ਹਾਂ ਹਾਂ ਹਾਂ ਤਿਉਹਾਰਾਂ ਦੇ ਦਿਨਾਂ ਕਰਕੇ ਨਾ ਅੱਜ ਕੱਲ੍ਹ ਹਰ ਇੱਕ ਜਿਹੜਾ ਲੋਕ ਨੇਗੇ ਮਤਲਬ ਬਾਜ਼ਾਰਾਂ ਦੇ ਵਿੱਚ ਸ਼ੋਪਿੰਗਾ ਕਰਦੇ ਫਿਰਦੇ ਨੇ ਨਾ ਅਤੇ ਇਸ ਕਰਕੇ ਭੀੜ ਬਹੁਤ ਵਧੀ ਪਈ ਹੈਂ ਇੱਕ ਟਰਾਲੀਆਂ ਹਾਂ ਮੰਡੀਆਂ ਦੇ ਵਿੱਚ ਹਾਂ ਉਹ ਭਜਾਈ ਲਈ ਜਾਂਦੇ ਉਹਦੇ ਨਾਲ ਵੀ ਬਹੁਤ ਜ਼ਿਆਦਾ ਟ੍ਰੈਫਿਕ ਐਕਸੀਡੈਂਟ ਬਹੁਤ ਹੋਈ ਜਾਂਦੇ ਨੇ ਕੱਲ੍ਹ ਇੱਕ ਇੱਥੇ ਆਪਣੇ ਕੋਲਜ ਕੋਲ ਐਕਸੀਡੈਂਟ ਹੋ ਗਿਆ ਅਤੇ ਹਾਂ ਉਹ ਇੱਕ ਪਾਸਿਓ ਮੁੰਡਾ ਨਾ ਛੋਟਾ ਹੀ ਸੀਗਾ ਬੱਚਾ ਉਹ ਉਮਰ ਵੀ ਉਹਦੀ ਹੈ ਨਹੀਂ ਸੀ ਇੰਨੀ ਅਤੇ ਉਹ ਬਹੁਤ ਤੇਜ਼ ਮਤਲਬ ਸਕੂਟਰ ਲਈ ਆਉਂਦਾ ਸੀਗਾ ਅਤੇ ਅੱਗੋਂ ਅੱਗੋਂ ਵੀ ਮੋੜ ਦੇ ਉੱਪਰ ਉਸਨੇ ਦੇਖਿਆ ਹੀ ਨਹੀਂ ਹੈਗਾ ਅਤੇ ਉਹ ਕਿਸੇ ਦੇ ਵਿੱਚ ਮਾਰਿਆ ਅਤੇ ਉੱਥੇ ਐਕਸੀਡੈਂਟ ਹੋ ਗਿਆ ਉਸਦੀ ਲੱਤ ਲੁਤ ਮਤਲਬ ਫਰੈਕਚਰ ਹੋ ਗਈ ਉੱਥੇ ਉਹਦੀ ਬੱਚੇ ਦੀ ਹਾਂ ਹੋਰ ਬੱਚੇ ਨੂੰ ਹੈ ਨਾ ਜਿੱਦਾਂ ਟ੍ਰੈਫਿਕ ਦਾ ਕੀ ਬਹੁਤ ਜ਼ਿਆਦਾ ਹੋ ਗਿਆ ਨਾ ਅੱਜ ਕੱਲ੍ਹ ਦੁਨੀਆਂ ਅੱਜ ਕੱਲ੍ਹ ਬਸ ਵਾਹਨਾਂ 'ਤੇ ਹੀ ਹੋ ਗਈ ਆ ਹੋਰ ਨਾਂ ਤਾਂ ਕੋਈ ਪੈਦਲ ਵਾਲਾ ਕਿਉਂ ਪਹਿਲਾਂ ਤਾਂ ਲੋਕ ਪੈਦਲ ਪੁਦਲ ਤੁਰੀ ਫਿਰਦੇ ਸੀਗੇ ਇੰਨੀ ਟ੍ਰੈਫਿਕ ਹੈ ਨਹੀਂ ਸੀਗੀ ਹੈਂ ਹਾਂ ਤੁਰਦੇ ਸੀ ਬਿਜਲੀ ਵਾਲੀਆ ਸਕੂਟਰੀਆਂ ਹਾਂ ਇਹਨਾਂ ਨੇ ਇਹਨਾਂ ਦਾ ਐਂ ਆ ਇਹਨਾਂ ਦੇ ਕਿਹੜਾ ਕੋਈ ਗੇਅਰ ਪੈਣਾ ਬਸ ਰੇਸ ਹੀ ਦੇਣੀ ਆ ਉਹ ਇੱਕਦਮ ਹੀ ਮ ਪੂਰੀ ਫੁੱਲ ਸਪੀਡ 'ਤੇ ਜਾਂਦੀਆਂ ਨੇਗੀਆਂ ਹੂੰ ਨਹੀਂ ਇਹ ਚੀਜ਼ ਨਹੀਂ ਇਹ ਚੀਜ਼ ਦਾ ਬਹੁਤ ਵਧੀਆ ਉਹ ਆ ਕਿਉਂਕਿ ਜੇਕਰ ਆਪਾਂ ਬੱਚਿਆਂ ਨੂੰ ਕੋਈ ਸਾਧਨ ਦਿੰਦੇ ਹਾਂ ਨਾ ਇੱਦਾਂ ਦੇ ਤਾਂ ਇਹਦੇ ਨਾਲ ਬੱਚਿਆਂ ਦੇ ਸੱਟ ਵੱਜਣ ਦੇ ਕਾਰਨ ਬਹੁਤ ਜ਼ਿਆਦਾ ਵੱਧ ਜਾਂਦੇ ਨੇਗੇ ਅਤੇ ਹਾਂ ਨਹੀਂ ਨਹੀਂ ਜਿੰਨਾ ਵੀ ਬਚਾਅ ਕੀਤਾ ਜਾਵੇ ਬੱਚਿਆਂ ਦਾ ਬਈ ਉੰਨਾ ਸਹੀ ਹੈਗਾ ਆਪ ਦਾ ਵੀ ਬਚਾਅ ਜਿੰਨਾ ਜਿੰਨਾ ਹੋ ਸਕੇ ਉੰਨਾ ਸਹੀ ਹੈਗਾ ਇੱਕ ਐਂ ਆ ਨਾ ਅੱਜ ਕੱਲ੍ਹ ਸਪੀਡ ਲਿਮਟ ਦੇ ਵਿੱਚ ਨਹੀਂ ਚਲਾ ਰਿਹਾ ਕੋਈ ਵੀ ਅੱਜ ਕੱਲ੍ਹ ਪੂਰੀ ਫੁੱਲ ਸਪੀਡਾਂ 'ਤੇ ਜਾ ਰਹੇ ਨੇਗੇ ਅਤੇ ਲੋਕਾਂ ਨੂੰ ਪਤਾ ਨਹੀਂ ਕਾਹਲੀ ਵੀ ਬਹੁਤ ਜ਼ਿਆਦਾ ਹੈ ਬਸ ਹੂੰ ਹਾਂ ਓ ਉਹ ਰੋਕ ਸਕਦੇ ਨੇਗੇ ਹਾਂ ਫਿਰ ਉਹ ਵੀ ਹੁਣ ਕਿੰਨਿਆਂ ਕੁ ਨੂੰ ਫੜੀ ਜਾਣ ਹਰ ਇੱਕ ਨੂੰ ਕਿੱਥੇ ਫੜਦੇ ਹੁੰਦੇ ਨੇ ਇਹ ਤਾਂ ਆਪਾਂ ਨੂੰ ਆਪ ਨੂੰ ਖੁਦ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਨਾ ਕੇ ਅਸੀਂ ਆਪ ਵੀ ਥੋੜ੍ਹਾ ਜਿਹਾ ਆਪ ਵੀ ਰਿਸਪੋਂਸੀਬਲ ਬਣੀਏ ਹੈ ਨਾ ਇਸ ਚੀਜ਼ ਦੇ ਪ੍ਰਤੀ ਹਾਂ ਹਾਂ ਹਾਂਜੀ ਜੀ ਹਾਂ ਅੱਜ ਕੱਲ੍ਹ ਵੈਸੇ ਯੁੱਗ ਹੀ ਤੁਹਾਨੂੰ ਪਤਾ ਹੀ ਹੈਗਾ ਵੀ ਬਸ ਫਾਸਟ ਯੁੱਗ ਆ ਗਿਆ ਅੱਜ ਕੱਲ੍ਹ ਲੋਕ ਸਾਧਨਾਂ 'ਤੇ ਵੀ ਉਸੇ ਤਰ੍ਹਾਂ ਹੀ ਤੁਰੀ ਜਾਂਦੇ ਨੇ ਗੇ ਚਲੋਂ ਉਹ ਹਾਂਜੀ ਹਾਂ ਮਾਰਾਂਗੇ ਗੇੜਾ ਵੀਰੇ ਓਕੇ ਕੋਈ ਗੱਲ ਨਹੀਂ ਅਤੇ ਚਲੋ ਠੀਕ ਹੈ ਵੀਰੇ ਮਿਲਦੇ ਹਾਂ ਆਪਾਂ ਫਿਰ ਓਕੇ ਠੀਕ ਠੀਕ ਹੈ ਜੀ ਸਤਿ ਸ਼੍ਰੀ ਅਕਾਲ